ਪੰਜਾਬ ਦੇ ਲੋਕਾਂ ਨੇ ਆਯੁਰਵੇਦਨ ਬਹੁਤ ਸਾਂਭ ਕੇ ਰੱਖਿਆ ਹੈ ਅੱਜ ਕੱਲ੍ਹ ਪੰਜਾਬ ਦੇ ਲੋਕਾਂ ਵਿੱਚ ਮੇਨਲੀ ਗੱਲ ਸੁਣੀ ਹੈ ਸਾਰੇ ਲੋਕ ਗੋਡਿਆਂ ਤੋਂ ਬਹੁਤ ਪਰੇਸ਼ਾਨ ਨੇ ਕਿਉਂਕਿ ਪਿੰਡਾਂ ਦੇ ਵਿੱਚ ਜ਼ਿਆਦਾ ਦੇਖਿਆ ਹੈ ਕਿ ਮਾਈਆਂ ਬਹੁਤ ਪਰੇਸ਼ਾਨ ਰਹਿੰਦੀਆਂ ਨੇ ਅਤੇ ਲੋਕ ਇਹਨਾਂ ਨੂੰ ਬਹੁਤ ਡਾਕਟਰੀ ਉਪਾਏ ਵੀ ਦੱਸਦੇ ਨੇ ਪਰ ਲੋਕ ਇੰਨਾਂ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਡਾਕਟਰੀ ਉਪਾਹਿਆਂ ਦਾ ਜਿਹੜੀ ਮੈਡੀਸਨ ਯੂਜ ਕਰਦੇ ਨੇ ਉਹਦਾ ਬਹੁਤ ਨੁਕਸਾਨ ਹੁੰਦਾ ਹੈ ਅਤੇ ਲੋਕ ਆਪਣੇ ਘਰ ਦੇ ਵਿੱਚ ਆਯੁਰਵੇਦਾ ਦਾ ਯੂਸ ਕਰਕੇ ਇੱਕ ਅੱਕ ਨਾਂ ਦਾ ਬੂਟਾ ਹੁੰਦਾ ਹੈ ਅਤੇ ਇੱਕ ਧਤੂਰੇ ਨਾਂ ਦਾ ਬੂਟਾ ਹੁੰਦਾ ਇਹਨਾਂ ਦੋਵਾਂ ਦੀਆਂ ਜੜਾਂ ਨੂੰ ਪੱਟ ਕੇ ਅਤੇ ਇਹਨਾਂ ਨੂੰ ਤੇਲ ਦੇ ਵਿੱਚ ਰਝਾ ਕੇ ਇਹਨਾਂ ਦਾ ਸੁਕਾ ਕੇ ਇਹਨਾਂ ਨੂੰ ਫਿਰ ਰਝਾ ਜਾ ਕੇ ਇਹਨਾਂ ਦਾ ਯੂਸ ਕਰਦੇ ਹਨ ਅਤੇ ਇਹਦੇ ਨਾਲ ਗੋਡੇ ਠੀਕ ਹੁੰਦੇ ਹਨ ਅਤੇ ਲੋਕ ਦਰਦ ਤੋਂ ਰਹਿਤ ਹੋ ਜਾਂਦੇ ਹਨ